ਸਥਾਨਕ ਆਵਾਜਾਈ ਸਾਡੀ ਬਹੁਤ ਪ੍ਰਭਾਵਿਤ ਹੋਈ ਹੈ ਮੇਨਲੀ ਸਥਾਨਕ ਆਵਾਜਾਈ ਲਈ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਆਟੋ ਜਾਂ ਬੱਸਿਸ ਹਨ ਆਟੋ ਆਪਾਂ ਨੀਅਰ ਬਾਏ ਕਿਤੇ ਵੀ ਜਾਣ ਲਈ ਨੇੜੇ ਤੇੜੇ ਕਿਸੇ ਵੀ ਜਗ੍ਹਾਵਾਂ ਜਾਣ ਲਈ ਉਪਲਬਧ ਹਨ ਅਤੇ ਬੱਸਿਸ ਆਪਾਂ ਜਦ ਕਿਤੇ ਦੂਰ ਜਾਂ ਕਿਸੇ ਵੀ ਸਿਟੀ ਤੱਕ ਜਾਣਾ ਹੈ ਤਾਂ ਆਪਾਂ ਬੱਸਿਸ ਲੈਂਦੇ ਹਾਂ ਕਈ ਵਾਰ ਬੱਸਾਂ ਆਪਣਾ ਟਾਈਮ ਤੋਂ ਮਿਸ ਕਰ ਜਾਂਦੀਆਂ ਹਨ ਅਤੇ ਕਈ ਵਾਰ ਅਸੀਂ ਲੇਟ ਵੀ ਹੋ ਜਾਂਦੇ ਹਨ ਕਿਉਂਕਿ ਬੱਸਾਂ ਦਾ ਟਾਈਮ ਸੀਮਿਤ ਹੈ ਅਤੇ ਦੂਸਰਾ ਆਟੋ ਆਟੋ ਅੱਜ ਕੱਲ੍ਹ ਆਪਣੇ ਕਿਰਾਏ ਵਧਾ ਦਿੱਤੇ ਹਨ ਅਤੇ ਜਿਸ ਨਾਲ ਆਪਣੀ